ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਤੁਹਾਡੀ ਵੈਬਸਾਈਟ ਤੋਂ ਈ ਬੁੱਕ ਕਰੀ ਹੈ ਇਹਦੀ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਮੇਰੇ ਕੋਈ ਪੈਸਾ ਨਹੀਂ ਲੱਗਿਆ ਇਸ ਨੂੰ ਡਾਊਨਲੋਡ ਕਰਨ ਦੇ ਵਿੱਚ ਅਤੇ ਇਹ ਇਸਦੇ ਪੇਜਿਸ ਸਾਰੇ ਹੀ ਸਾਫ਼ ਸੁਥਰੇ ਹਨ ਅਤੇ ਚੰਗੀ ਤਰ੍ਹਾਂ ਪੜ੍ਹੇ ਜਾ ਸਕਦੇ ਹਨ ਅਤੇ ਇਸ ਨੂੰ ਕੋਪੀ ਪੇਸਟ ਵੀ ਕੀਤਾ ਜਾ ਸਕਦਾ ਹੈ ਇਹ ਮੈਂ ਅੱਗੇ ਆਪਣੇ ਯਾਰ ਦੋਸਤਾਂ ਨੂੰ ਵੀ ਭੇਜੀ ਹੈ ਉਹ ਵੀ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਵੀ ਅੱਗੋਂ ਇਸ ਇੱਥੋਂ ਈ ਬੁੱਕ ਤੁਹਾਡੀ ਵੈਬਸਾਈਟ 'ਤੇ ਈ ਬੁੱਕ ਡਾਊਨਲੋਡ ਕੀਤੀ ਹੈ